ਰਾਜ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਹੋਰ ਜਾਣਨ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਲਈ ਕੁਝ ਵਿਕਲਪ ਇਹ ਹਨ ਕਿ ਸਰਕਾਰੀ ਕਾਲਜ ਰੋਪੜ ਵਿੱਚ ਅਜਾਇਬ ਘਰ ਵਿੱਚ ਮਨੁੱਖ ਦਾ ਢਾਂਚਾ ਰੱਖਿਆ ਗਿਆ ਹੈ ਜਿਸ ਵਿੱਚ ਸਾਨੂੰ ਮਨੁੱਖ ਦੇ ਅੰਦਰੂਨੀ ਢਾਂਚੇ ਬਾਰੇ ਪਤਾ ਲੱਗਦਾ ਹੈ ਇਹ ਬਹੁਤ ਦਿਤ ਦਿਲਚਸਪ ਦਿਲਚਸਪ ਹੈ ਸਾਨੂੰ ਇਸ ਬਾਰੇ ਕਈ ਜਾਣਕਾਰੀ ਵੀ ਮਿਲਦੀ ਹੈ ਇਸ ਵਿੱਚ ਮਨੁੱਖ ਦੇ ਅੰਦਰਲੀ ਨਾੜਾਂ ਅੰਗਾਂ ਬਾਰੇ ਅੰਦਰੂਨੀ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਸੱਭਿਆਚਾਰ ਕੇਂਦਰ ਵਿੱਚ ਸਾਨ ਅਸੀਂ ਦੇਖਿਆ ਹੈ ਕਿ ਰਣਜੀਤ ਸਿੰਘ ਬਾਗ਼ ਵਿੱਚ ਤੀਆਂ ਦੇ ਤਿਉਹਾਰ 'ਤੇ ਕਈ ਮੇਲਾ ਲੱਗਦਾ ਹੈ ਅਤੇ ਲੜਕੀਆਂ ਕੁੜੀਆਂ ਪੀਂਘਾਂ ਝੂਟਦੀਆਂ ਹਨ ਮਹਿੰਦੀ ਲਾਉਂਦੀਆਂ ਹਨ ਗਿੱਧਾ ਪਾਉਂਦੀਆਂ ਹਨ ਅਤੇ ਇਹ ਬਹੁਤ ਦਿਲ ਦਿਲਚਸਪ ਹੈ